ਸਾਡੇ ਪੰਜਾਬ ਵਿੱਚ ਕੁੱਲ ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਹਲਮ ਹਨ ਜਿਹਨਾਂ ਵਿੱਚੋਂ ਜੋ ਕਿ ਪੰਜਾਬ ਵਿੱਚ ਤਿੰਨ ਦਰਿਆ ਰਾਵੀ ਬਿਆਸ ਤੇ ਸਤਲੁਜ ਚੱਲ ਰਹੇ ਤੇ ਦੋ ਦਰਿਆ ਚਨਾਬ ਤੇ ਜੇਹਲਮ ਪਾਕਿਸਤਾਨ ਵੱਲ ਹਨ ਪੰਜਾਬ ਸਟੇਟ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜੋ ਕਿ ਮਾਝਾ ਦੁਆਬਾ ਅਤੇ ਮਾਲਵਾ ਹਨ ਇਹਨਾਂ ਪੰਜ ਦਰਿਆਵਾਂ ਵਿੱਚੋਂ ਸਭ ਤੋਂ ਵੱਡਾ ਦਰਿਆ ਸਤਲੁਜ ਹੈ ਜੋ ਕਿ ਪੰਜਾਬ ਦੇ ਉੱਤਰੀ ਭਾਰਤ ਹਿੱਸੇ ਵਿੱਚ ਤਿੱਬਤ ਹਿਮਾਚਲ ਪ੍ਰਦੇਸ਼ ਵਿੱਚ ਵਹਿੰਦਾ ਹੈ ਜੋ ਕਿ ਪਾਕਿਸਤਾਨ ਵਿੱਚ ਹੋ ਕੇ ਵਹਿੰਦਾ ਹੈ ਇਸ ਦੀ ਲੰਬਾਈ ਸਾਢੇ ਚੌਦ੍ਹਾਂ ਸੌ ਕਿਲੋਮੀਟਰ ਹੈ ਸਾਡੇ ਪੰਜਾਬ ਵਿੱਚ ਦਰਿਆ ਦੇ ਨਾਲ ਨਾਲ ਕਾਫੀ ਡੈਮ ਵੀ ਮੌਜੂਦ ਹਨ ਜਿਵੇਂ ਕਿ ਭਾਖੜਾ ਡੈਮ ਜਿਹਨਾਂ ਦੀ ਸੰਖਿਆ ਚੌਦ੍ਹਾਂ ਦੇ ਆਸ ਪਾਸ ਹੈ ਇਸ ਵਿੱਚ ਭਾਖੜਾ ਨੰਗਲ ਡੈਮ ਰਣਜੀਤ ਸਾਗਰ ਡੈਮ ਆਦਿ ਵੀ ਸ਼ਾਮਿਲ ਹਨ ਪਾਣੀ ਦੀ ਵਰਤੋਂ ਲੋਕ ਅੱਜ ਕੱਲ੍ਹ ਬਹੁਤ ਸਾਰੇ ਤਰੀਕੇ ਨਾਲ ਕਰ ਰਹੇ ਹਨ ਅਸੀਂ ਸੀਵਰੇਜ ਦੇ ਵੇਸਟ ਨੂੰ ਵੀ ਪਾਣੀ ਦੀ ਬਰਬਾਦੀ ਕਹਿ ਸਕਦੇ ਹਾਂ ਜਿਵੇਂ ਕਿ ਲੋਕਾਂ ਦੇ ਸਮੂਹ ਦੁਆਰਾ ਕੀਤਾ ਜਾਂਦਾ ਹੈ ਜੇਕਰ ਪਾਣੀ ਦੀ ਬਰਬਾਦੀ ਇਸ ਤਰ੍ਹਾਂ ਨਾਲ ਹੀ ਹੁੰਦੀ ਰਹੀ ਤਾਂ ਅਸੀਂ ਕੱਲ੍ਹ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਪਾਣੀ ਲਈ ਵੀ ਤਰਸੇਗੀ ਕਿਉਂਕਿ ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ ਅਤੇ ਜੇ ਪਾਣੀ ਦੀ ਸੰਭਾਲ ਨਹੀਂ ਕਰਾਂਗੇ ਤਾਂ ਜੀਵਨ ਦਾ ਆਧਾਰ ਵੀ ਇੱਕ ਦਿਨ ਖਤਮ ਹੋ ਜਾਵੇਗਾ